ਮੇਰੇ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਇਸ ਦੇ ਸਾਰਾ ਕੁਝ ਵਾਸਤਵਿਕ ਚਸ਼ਮੇ ਦੀ ਸਹਿਕਾਰੀ ਦੇਹ ਅਤੇ ਉਸਦੇ ਗੂੰਜ ਅਤੇ ਜਟਿਲਤਾ ਦੇ ਬਿੰਦੂ ਹੈ ਇੱਕ ਚਸ਼ਮੇ ਵਿੱਚ ਨਜ਼ਰ ਡੱਕਣ ਦਾ ਮੌਕਾ ਮੈਨੂੰ ਮਿਲੀਅਨ ਸਾਲਾਂ ਦੂਰ ਹੋਣ ਵਾਲੀਆਂ ਸਿਤਾਰੇ ਸਿਤਾਰਿਆਂ ਦੀਆਂ ਬਿਸਮਤਾਂ ਨੂੰ ਸ਼ਾਕਸ਼ਾਤ ਦੇਖਣ ਦਾ ਮੌਕਾ ਦਿੰਦਾ ਹੈ ਬਲੈਕ ਹੌਲ ਦੀ ਰਹੱਸ ਸਿਤਾਰਿਆਂ ਦੀ ਪੈਦਾਇਸ਼ ਅਤੇ ਮੌਤ ਸੰਭਾਵਿਕ ਨਿਵਾਸਯੋਗ ਗ੍ਰਹਿ ਦੀ ਸੰਭਾਵਨਾ ਅਤੇ ਬ੍ਰਹਿਮੰਡ ਦੀ ਮੂਲ ਉੱਤਪੱਤੀ ਦੀ ਰਹੱਸ ਕਰਕੇ ਬਹੁਤ ਪਰਚਣਾ ਪਰਚਣਾ ਹੁੰਦੀ ਹੈ